ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਆ ਅਤੇ ਮੈਂ ਪੰਜਾਬ ਤੋਂ ਬੋਲਦੀ ਪਈ ਹਾਂ ਗੁਰਦਾਸਪੁਰ ਤੋਂ ਹਾਂਜੀ ਅੱਜ ਸਾਡੇ ਮੈਂ ਅੱਜ ਇੱਕ ਮੈਂ ਆਪਣੇ ਲਾਗੇ ਜਿਹੜੇ ਆਪਣੇ ਵਾਤਾਵਰਣ ਜਿਹੜਾ ਅਸੀਂ ਸੁਣਦੇ ਆ ਇਹਦੇ ਬਾਰੇ 'ਚ ਮੈਂ ਚਰਚਾ ਕਰਨਾ ਚਾਹੁੰਦੀ ਹਾਂ ਕਿਉਂਕਿ ਅੱਜ ਕੱਲ੍ਹ ਵਾਤਾਵਰਣ ਸਾਡਾ ਜਿਹੜਾ ਵਾਤਾਵਰਣ ਜਿਹੜਾ ਆ ਬਹੁਤ ਹੀ ਮਤਲਵ ਦੂਸ਼ਿਤ ਹੁੰਦਾ ਜਾ ਰਿਹਾ ਉਹਦਾ ਮਤਲਬ ਮੇਨ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਅਸੀਂ ਲੋਕ ਕਿਉਂਕਿ ਅਸੀਂ ਮਤਲਬ ਵਾਤਾਵਰਣ ਨੂੰ ਆਪਣੇ ਪਰਿਆਵਰਨ ਆਪਣੇ ਵਾਤਾਵਰਣ ਨੂੰ ਸਾਫ਼ ਤਾ ਨਹੀਂ ਰੱਖਦੇ ਇੱਕ ਤਾਂ ਅਸੀਂ ਜਿੰਨੇ ਵੀ ਮਤਲਵ ਪੇੜ ਪੌਦੇ ਨਹੀਂ ਲਗਾਉਂਦੇ ਜਿਹੜੇ ਲਗਾਏ ਹੋੋਏ ਆ ਜਿਹੜੇ ਮਤਲਬ ਬਰਿਖਸ਼ ਅਸੀਂ ਵੱਡ ਦਿੰਦੇ ਹਾਂ ਉਹਦੇ ਨਾਲ ਕੀ ਹੁੰਦਾ ਅਤੇ ਸਾਡੇ ਕਮੀ ਹੁੰਦੀ ਹੈਗੀ ਆ ਅਤੇ ਦੂਸਰਾ ਜਿਹੜੀ ਆ ਹਵਾ ਮੀਨਸ ਸਾਨੂੰ ਸ਼ੁੱਧ ਹਵਾ ਵੀ ਨਹੀਂ ਮਿਲਦੀ ਹੈਗੀ ਅਤੇ ਹੋਰ ਸਾਡੇ ਵਾਤਾਵਰਣ ਜਿਹੜਾ ਦੂਸ਼ਿਤ ਹੁੰਦਾ ਹੈ ਇੱਕ ਤਾਂ ਲੋਕ ਕਰਦੇ ਆ ਮਤਲਬ ਹਵਾ ਪ੍ਰਦੂਸ਼ਨ ਕਰਕੇ ਵੀ ਵਾਤਾਵਰਣ ਸਾਡਾ ਜਿਹੜਾ ਖਰਾਬ ਹੁੰਦਾ ਆ ਅਤੇ ਉਹ ਮਤਲਬ ਸਾਨੂੰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਮਤਲਬ ਆਪਣੇ ਬੂਟੇ ਲਗਾਉਣੇ ਚਾਹੀਦੇ ਆ ਜਿਸ ਤਰਾਂ ਸਾਡਾ ਜਿਹੜਾ ਵਾਤਾਵਰਣ ਜਿਹੜਾ ਆ ਉਹ ਮਤਲਬ ਸ਼ੁੱਧ ਰਹਿ ਸਕੇ ਸਾਨੂੰ ਮਤਲਬ ਉਹਦੇ ਲਈ ਕੀ ਕਰਨਾ ਚਾਹੀਦਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਉਣੇ ਚਾਹੀਦੇ ਆ ਹੁਣ ਸਾਡੇ ਜਿਹੜੇ ਮਤਲਬ ਜਿਹੜਾ ਕੂੜੇ ਲੋਕ ਕੀ ਕਰਦੇ ਆ ਜਿਹੜੇ ਇਸ ਤਰ੍ਹਾਂ ਸੜਕਾਂ 'ਤੇ ਸੁੱਟ ਜਾਂਦੇ ਹਨ ਕੂੜੇ ਸਾਨੂੰ ਮਤਲਬ ਬਾਹਰ ਜਿਸ ਤਰ੍ਹਾਂ ਗੰਦਗੀ 'ਚ ਨਹੀਂ ਸੁੱਟਣਾ ਚਾਹੀਦਾ ਸਾਨੂੰ ਜਿਹੜੇ ਜਿਹੜੇ ਮਤਲਬ ਸਰਕਾਰ ਵੱਲੋਂ ਵੱਡੇ ਵੱਡੇ ਉਹਨਾਂ ਨੇ ਜਿਹੜੇ ਡਸਬਿਨ ਜਿਹੜੇ ਵੱਡੇ ਵੱਡੇ ਕੂੜੇ ਦਾਨ ਲਗਾਏ ਹੁੰਦੇ ਆ ਸਾਨੂੰ ਗਿੱਲਾ ਸੁ ਗਿੱਲਾ ਕੂੜਾ ਜਿਹੜਾ ਗਿੱਲੇ ਵਿੱਚ ਪਾਉਣਾ ਚਾਹੀਦਾ ਅਤੇ ਜਿਹੜਾ ਸੁੱਕਾ ਕੂੜਾ ਸੁੱਕੇ ਵੀ ਪਾਉਣਾ ਚਾਹੀਦਾ ਸਾਨੂੰ ਗੰਦਗੀ ਮਤਲਬ ਧਿਆਨ ਦੇਣਾ ਰੱਖਣਾ ਚਾਹੀਦਾ ਸਾਨੂੰ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਜਿਹੜਾ ਆ ਇਹ ਸਾਫ਼ ਸੁਥਰੇ ਕੰਮ ਕਰਨੇ ਚਾਹੀਦੇ ਹੈਗੇ ਆ ਅਤੇ ਮਤਲਬ ਕਿਉਂਕਿ ਇਹਨਾਂ ਕਰਕੇ ਸਾਡੇ ਵਾਤਾਵਰਣ ਜਿਹੜਾ ਦੂਸ਼ਿਤ ਹੋ ਜਾਂਦਾ ਉਹਦੇ ਨਾਲ ਸਾਨੂੰ ਮਤਲਬ ਇੱਕ ਤਾਂ ਜਿਹੜੇ ਦੂਸਰੀ ਗੱਲ ਆ ਜਿਹੜੇ ਵਾਹਨ ਦੇ ਜਿਹੜੇ ਅਹੀਂ ਵਾਹਨ ਦੀ ਜ਼ਿਆਦਾ ਮਤਲਬ ਵਰਤੋਂ ਕਰਦੇ ਹੈਗੇ ਹਾਂ ਵਾਹਨਾਂ ਕਰਕੇ ਅਤੇ ਧੂਆਂ ਕਰਕੇ ਵੀ ਸਾਡਾ ਜਿਹੜਾ ਵਾਤਾਵਰਣ ਜਿਹੜਾ ਦੂਸ਼ਿਤ ਹੋ ਜਾਂਦਾ ਸਾਨੂੰ ਇਹਨਾਂ ਵਾਹਨਾਂ ਦੀ ਵੀ ਘੱਟ ਤੋਂ ਘੱਟ ਉਪਯੋਗ ਕਰਨਾ ਚਾਹੀਦਾ ਅਤੇ ਸਾਨੂੰ ਪੈਦਲ ਹੀ ਜਾਣ ਦੀ ਪ੍ਰੋਸੀਕੇਟ ਲਾਗੇ ਲੱਗੇ ਕੰਮ ਹੁੰਦੇ ਆ ਸਾਨੂੰ ਥੋੜ੍ਹੇ ਬਹੁਤੇ ਲਾਗੇ ਲਾਗੇ ਜਾ ਕੇ ਪੈਦਲ ਜਾਣਾ ਚਾਹੀਦਾ ਸਾਨੂੰ ਵੀ ਮੋਟਰਸਾਈਕਲ ਸਕੂਟਰਾਂ 'ਤੇ ਨਹੀਂ ਜਾਣਾ ਚਾਹੀਦਾ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਉਮੀਦੇ ਕੋਸ਼ਿਸ਼ ਕਰਨੀ ਚਾਹੀਦੀ ਹੈ ਧੰਨਵਾਦ